ਸਾਡੇ ਜਿਹੜਾ ਭਾਰਤ ਹੈ ਉਹਦੇ ਵਿੱਚ ਜਿਹੜਾ ਗੁਜਰਾਤ ਹੈ ਰਾਜ ਹੈ ਉੱਥੇ ਨਾ ਇੱਕ ਸਟੈਚੂ ਬਹੁਤ ਵੱਡਾ ਬਣਿਆ ਹੋਇਆ ਜਿਹੜਾ ਕਿ ਦੁਨੀਆਂ ਦਾ ਸਭ ਤੋਂ ਵੱਡਾ ਹੈ ਜਿਹੜਾ ਸਟੈਚੂ ਹੈ ਸਰਦਾਰ ਵੱਲਭ ਭਾਈ ਪਟੇਲ ਦਾ ਜਿਹੜਾ ਸਟੈਚੂ ਹੈ ਬਣਾਇਆ ਹੋਇਆ ਹੈ ਉਹ ਦੁਨੀਆਂ ਤੋਂ ਸਭ ਤੋਂ ਉੱਚਾ ਸਟੈਚੂ ਹੈ ਸਭ ਤੋਂ ਉੱਚੀ ਇਮਾਰਤ ਹੈ ਜਿਸਨੂੰ ਦੂਰੋਂ ਦੂਰੋਂ ਲੋਕ ਹੈ ਜਿਹੜੇ ਦੇਖਣ ਵੀ ਆਉਂਦੇ ਨੇ ਅਤੇ ਉਸ ਦੇ ਉੱਤੇ ਹਜ਼ਾਰਾਂ ਕਰੋੜਾਂ ਦਾ ਜਿਹੜਾ ਖਰਚਾ ਹੈ ਉਹ ਕੀਤਾ ਹੈ ਸਰਕਾਰ ਨੇ ਅਤੇ ਜਿਸ ਕਾਰਨ ਜਿਹੜਾ ਟੂਰਿਜ਼ਮ ਹੈ ਸਾਡੇ ਭਾਰਤ ਦੇ ਵਿੱਚ ਵਧਿਆ ਹੈ ਅਤੇ ਜਿਸ ਕਰਕੇ ਸਾਡੇ ਜਿਹੜੇ ਬਹੁਤ ਸਾਰੇ ਨੌਜਵਾਨ ਨੇ ਉਹਨਾਂ ਨੂੰ ਰੁਜ਼ਗਾਰ ਵੀ ਮਿਲਿਆ ਹੈ ਅਤੇ ਇਹ ਜਿਹੜੀ ਕਲਾ ਹੈ ਜਿਹੜੀ ਉਹ ਦਿਖਾਈ ਹੋਈ ਹੈ ਇਹ ਬਹੁਤ ਹੀ ਦੇਖਣ ਦੇ ਵਿੱਚ ਵੀ ਬੜੀ ਹੀ ਵਧੀਆ ਲੱਗਦੀ ਹੈ ਅਤੇ ਸਾਨੂੰ ਮਾਣ ਵੀ ਹੁੰਦਾ ਹੈ ਕਿ ਜਿਹੜੀ ਸਭ ਤੋਂ ਸਾਰੇ ਦੇਸ਼ਾਂ ਦੇ ਵਿੱਚ ਉਹ ਜਿਹੜਾ ਇਹ ਭਾਰਤ ਹੈ ਉਹ ਦੇ ਵਿੱਚ ਇਹ ਜਿਹੜਾ ਸਟੈਚੂ ਹੈ ਉਹ ਮੌਜੂਦ ਹੈ